ਸਤਿ ਸ਼੍ਰੀ ਅਕਾਲ ਜੀ ਮੈਂ ਪਿਛਲੇ ਹਫਤੇ ਤੁਹਾਡੇ ਵੈੱਬਸਾਈਟ ਤੋਂ ਇੱਕ ਲੈਪਟਾਪ ਖਰੀਦਿਆ ਸੀ ਜੋ ਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਪਹਿਲਾਂ ਤਾਂ ਜਦੋਂ ਮੈਂ ਉਸਦੀ ਉਸਦੀ ਪੈਕਿੰਗ ਤੋਂ ਹੀ ਮੈਂ ਨਾ ਖੁਸ਼ ਹਾਂ ਕਿਉਂਕਿ ਤੁਸੀਂ ਉਹਦੀ ਉਨ੍ਹਾਂ ਉਸਦੀ ਪੈਕਿੰਗ ਬਿਲਕੁਲ ਹੀ ਸਹੀ ਢੰਗ ਨਾਲ ਨਹੀਂ ਕੀਤੀ ਹੋਈ ਸੀ ਜਿਸ ਕਰਕੇ ਕਿ ਉਹ ਮੇਰੇ ਕੋਲ ਇੱਕ ਡੈਮੇਜ ਪ੍ਰੋਡਕਟ ਆਇਆ ਹੈ ਜਦੋਂ ਉਸਨੂੰ ਮੈਂ ਓਪਨ ਕੀਤਾ ਤਾਂ ਉਸਦੀ ਸਕਰੀਨ ਪਹਿਲਾਂ ਹੀ ਟੁੱਟੀ ਹੋਈ ਸੀ ਜਦੋਂ ਅਸੀਂ ਜਦੋਂ ਅਸੀਂ ਉਹਨੂੰ ਔਨ ਕੀਤਾ ਤਾਂ ਉਹਦੀ ਬੈਟਰੀ ਵੀ ਬਿਲਕੁਲ ਡੈਡ ਸੀਗੀ ਘੰਟੇ ਬਾਅਦ ਅਸੀਂ ਉਹਨੂੰ ਚਾਰਜ ਲਾ ਕੇ ਦੇਖਿਆ ਤਾਂ ਉਹਦੀ ਬੈਟਰੀ ਬੈਕਅਪ ਵੀ ਬਿਲਕੁਲ ਸਹੀ ਨਹੀਂ ਸੀਗਾ ਕੁੱਲ ਮਿਲਾ ਕੇ ਮੈਂ ਤੁਹਾਡੇ ਪ੍ਰੋਡਕਟ ਤੋਂ ਬਿਲਕੁਲ ਵੀ ਸੰਤੁਸ਼ਟ ਨਹੀ ਹਾਂ ਕਿਰਪਾ ਕਰਕੇ ਮੈਂ ਤਾਂ ਚਾਹੁੰਦੀ ਆ ਕਿ ਤੁਸੀਂ ਮੇਰੇ ਪੈਸੇ ਵਾਪਸ ਕਰ ਦੋ ਪਰ ਜੇਕਰ ਪੈਸੇ ਵਾਪਸ ਨਹੀਂ ਕੀਤੇ ਜਾ ਸਕਦੇ ਤਾਂ ਪਲੀਜ਼ ਮੈਨੂੰ ਵਧੀਆ ਪ੍ਰੋਡਕਟ ਦੋ ਨਹੀਂ ਤੋਂ ਅੱਗੇ ਤੋਂ ਮੈਂ ਤੁਹਾਡੀ ਵੈਬਸਾਈਟ 'ਤੇ ਦੁਬਾਰਾ ਸ਼ੋਪਿੰਗ ਨਹੀਂ ਕਰਾਂਗੀ